ਹਾਂਜੀ ਅਸੀਂ ਕਿਸ ਕਈ ਤਰ੍ਹਾਂ ਦੇ ਪੌਦੇ ਲਾਉਂਦੇ ਜਿਵੇਂ ਕਿ ਗੁਲਾਬ ਦੇ ਹੋਗੇ ਫੁੱਲ ਬੂਟਿਆਂ ਦੇ ਹੋਗੇ ਫਲਾਂ ਦੇ ਹੋਗੇ ਸਾਡੇ ਘਰ ਵਿੱਚ ਕਈ ਤਰ੍ਹਾਂ ਦੇ ਫਲ ਬੂਟਿਆਂ ਲੱਗੇ ਹੋਏ ਹਨ ਅਤੇ ਵੇਲ੍ਹਾਂ ਐਂ ਕਿ ਜਿਵੇਂ ਕਿ ਆਪਣੀ ਸਬਜ਼ੀ ਹੋਗੀਆਂ ਇਹਨਾਂ ਦੀਆਂ ਵੇਲ੍ਹਾਂ ਉਗਾਉਂਦੇ ਹਨ